ਹਾਂਜੀ ਮੈਂ ਆਪਣੇ ਜੀਵਨ ਦੇ ਵਿੱਚ ਆਪਣੀ ਸੱਚ ਮੁੱਚ ਸੋਚਣ ਉਕਸਾਉਣ ਵਾਲੀ ਵਾਲੀਆਂ ਕਿਤਾਬਾਂ ਪੜ੍ਹੀਆਂ ਹਨ ਪਰ ਮੈਨੂੰ ਇੱਕ ਕਿਤਾਬ ਜੋ ਹੈ ਛੋਟੇ ਸਾਹਿਬਜ਼ਾਦੇ ਉਸ ਨੂੰ ਪੜ੍ਹ ਕੇ ਬੜਾ ਹੀ ਚੰਗਾ ਲੱਗਿਆ ਅਤੇ ਉਸ ਦੇ ਵਿੱਚ ਇਹ ਦੱਸਿਆ ਹੋਇਆ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਛੋਟੀ ਉਮਰ ਦੇ ਵਿੱਚ ਕਿਵੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਆਪਣੇ ਧਰਮ ਨੂੰ ਬਚਾਉਣ ਦੇ ਲਈ ਉਹਨਾਂ ਨੇ ਉਹ ਬਿਲਕੁਲ ਵੀ ਆਪਣੇ ਧਰਮ ਤੋਂ ਨਹੀਂ ਡੋਲੇ ਅਤੇ ਹਾਂਜੀ ਮੈਂ ਅਪ ਇੱਕ ਲੋਇੰਸ ਰੀਡਿੰਗ ਕਲੱਬ ਨੂੰ ਜੁਆਇਨ ਕੀਤਾ ਹੋਇਆ ਹੈ